ਹੈਲੋ ਹਾਂਜੀ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਮੈ ਇਸ਼ਪ੍ਰੀਤ ਬੋਲ ਰਹੀ ਹਾਂ ਜੀ ਮੈਨੂੰ ਮੇਰੀ ਫਰੈਂਡ ਨੇ ਤੁਹਾਡਾ ਨੰਬਰ ਦਿੱਤਾ ਸੀ ਮੈਂ ਫਤਿਹਗੜ੍ਹ ਸਾਹਿਬ ਘੁੰਮਣ ਆਉਣਾ ਸੀਗਾ ਅਤੇ ਮੈਨੂੰ ਉਹਨਾਂ ਨੇ ਦੱਸਿਆ ਸੀ ਵੀ ਤੁਸੀਂ ਲੋਕਲ ਹੈ ਫਤਿਹਗੜ੍ਹ ਸਾਹਿਬ ਰਹਿੰਦੇ ਹੋ ਅਤੇ ਤੁਸੀਂ ਮੈਨੂੰ ਸ਼ਹਿਰ ਬਾਰੇ ਕਾਫੀ ਜਾਣਕਾਰੀ ਦੇ ਸਕਦੇ ਹੋ ਵੀ ਇੱਥੇ ਕਿਹੜੀਆਂ ਜਗ੍ਹਾ ਨੇ ਜਿੱਥੇ ਅਸੀਂ ਜਾ ਸਕਦੇ ਹਾਂ ਮੈਂ ਐਕਚੁਲੀ ਕਨੇਡਾ ਤੋਂ ਆਈ ਹੋਈ ਹਾਂ ਪੰਦਰਾਂ ਕੁ ਦਿਨ ਲਈ ਅਤੇ ਮੈਮ ਮੈਨੂੰ ਤੁਸੀਂ ਇਹ ਦੱਸੋਗੇ ਮੇਰੇ ਕੋਲ ਦੋ ਦਿਨ ਹੈ ਐਕਚੁਲੀ ਅਤੇ ਮੈਂ ਇਹ ਜਾਨਣਾ ਚਾਹੁੰਦੀ ਸੀ ਵੀ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਮੇਰੇ ਕੋਲ ਕਿਹੜੀਆਂ ਕਿਹੜੀਆਂ ਥਾਵਾਂ ਨੇ ਪਲੱਸ ਇੱਥੇ ਮੌਸਮ ਕਿਹੋ ਜਿਹੇ ਹੈਗਾ ਜਿਹੜਾ ਮੈਂ ਅ ਘੁੰਮਣ ਆਉਣਾ ਅਤੇ ਕਿਹੋ ਜਿਹੇ ਕੱਪੜੇ ਮੈਂ ਨਾਲ ਚੱਕਾ ਮੇਰੇ ਨਾਲ ਇੱਕ ਛੋਟਾ ਬੱਚਾ ਵੀ ਹੈ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਅਸੀਂ ਚੰਡੀਗੜ੍ਹ ਮੈਂ ਚੰਡੀਗੜ੍ਹ ਦੀ ਉਤਰਨਾ ਚੰਡੀਗੜ੍ਹ ਆ ਕੇ ਏਅਰਪੋਰਟ 'ਤੇ ਉਹ ਕਰੂੰਗੀ ਲੈਂਡ ਠੀਕ ਹੈ ਠੀਕ ਹੈ ਜੀ ਮੈਂ ਟੈਕਸੀ 'ਤੇ ਆ ਰਹੀ ਹਾਂ ਟੈਕਸੀ ਵਾਲੇ ਨੂੰ ਉੱਥੇ ਪਤਾ ਹੋਏਗਾ ਆਈ ਥਿੰਕ ਵੀ ਹਾਂ ਇੱਧਰਲਾ ਏਰੀਏ ਦਾ ਠੀਕ ਹੈ ਮੈਮ ਠੀਕ ਹੈ ਜੀ ਮੇਨ ਇਹ ਆ ਵੀ ਮੈਨੂੰ ਕੱਪੜੇ ਬਹੁਤ ਨਹੀਂ ਚੱਕਣ ਦੀ ਲੋੜ ਠੀਕ ਹੈ ਠੀਕ ਹੈ ਓਕੇ